ਪ੍ਰਾਰਥਨਾਵਾਂ ਅਤੇ ਉਪਾਸਨਾ ਬਾਰੇ ਝੂਠ ਨਹੀਂ ਬੋਲਣਾ ਚਾਹੀਦਾ ਪਰ ਕੁਝ ਲੋਕ ਪ੍ਰਾਰਥਨਾ ਕਰਦੇ ਸਮੇਂ ਸੁੱਖਾਂ ਸੁੱਖਦੇ ਨੇ ਵੀ ਸਾਡਾ ਇੱਦਾਂ ਇਹ ਕੰਮ ਹੋ ਜਾਵੇ ਅਸੀਂ ਇਹ ਕਰਕੇ ਜਾਵਾਂਗੇ ਉਹਤੋਂ ਬਾਅਦ ਕੰਮ ਆਪਣਾ ਪੂਰਾ ਹੋ ਜਾਂਦਾ ਅਰਦਾਸ ਪੂਰੀ ਹੋ ਜਾਂਦੀ ਹੈ ਅਜੋ ਵਿਅਕਤੀ ਇੱਥੇ ਸੁੱਖਦਾ ਉਹ ਆਪਣੀ ਸੁੱਖ ਨੂੰ ਭੁੱਲ ਜਾਂਦਾ ਦੁਨਿਆਵੀ ਚੱਕਰ ਦੇ ਵਿੱਚ ਆ ਕੇ ਉੱਥੇ ਫਿਰ ਉਹ ਜਿਹੜੀ ਅਰਦਾਸ ਹੈ ਪ੍ਰਾਰਥਨਾ ਉਪਾਸਨਾ ਆਪਾਂ ਕੁਛ ਵੀ ਕਹਿ ਸਕਦੇ ਹਾਂ ਉਹ ਉੱਥੇ ਝੂਠੀ ਹੋ ਜਾਂਦੀ ਹੈ ਕਿਉਂਕਿ ਤੁਸੀਂ ਨੇ ਅਰਦਾਸ ਕਰਨ ਸਮੇਂ ਕੁਝ ਗੱਲਾਂ ਨੇ ਜੋ ਆਪਣੇ ਮਨ ਵਿੱਚ ਜੋ ਆਪਣੇ ਪਰਮਾਤਮਾ ਨਾਲ ਵਾਹਿਗੁਰੂ ਨਾਲ ਜੋ ਵੀ ਕੀਤੀਆਂ ਉਹ ਤੁਸੀਂ ਪੂਰੇ ਨਹੀਂ ਉਤਰਦੇ ਉਹਨਾਂ ਉੱਤੇ ਪੂਰੇ ਨਾਂ ਉਤਰਨ ਕਰਕੇ ਉਹ ਜਿਹੜੀ ਅਰਦਾਸ ਹੈ ਉਹ ਇਕ ਤਰ੍ਹਾਂ ਦੀ ਝੂਠੀ ਹੋ ਜਾਂਦੀ ਹੈ ਉਸ ਨੂੰ ਫਿਰ ਤੁਸੀਂ ਬਾਅਦ ਵਿਚ ਮਹਿਸੂਸ ਕਰਦੇ ਹੋ ਵੀ ਇਹ ਮੇਰੇ ਨਾਲ ਗਲਤ ਹੋਇਆ ਜਾਂ ਕਿਵੇਂ ਵੀ ਹੋਇਆ ਇਹ ਫਿਰ ਜਦੋਂ ਫੀਲਿੰਗਸ ਨੇ ਬੰਦੇ ਦੀਆਂ ਉਹ ਮਹਿਸੂਸ ਕਰਦਾ ਉਹ ਉਹਨੂੰ ਪਤਾ